ਲਿਖਣਾ ਮੇਰਾ ਸ਼ੌਂਕ ਅਤੇ ਨਾਲ ਨਾਲ ਮੈਨੂੰ ਮੇਰਾ ਪ੍ਰੋਫੈਸ਼ਨ ਵੀ ਹੈ ਕਿਉਂਕਿ ਮੈਂ ਇੱਕ ਟੀਚਰ ਹਾਂ ਅਧਿਆਪਕ ਹਾਂ ਅਤੇ ਮੈਂ ਬੱਚਿਆਂ ਨੂੰ ਲਿਖਵਾਉਂਦੀ ਵੀ ਹਾਂ ਅਤੇ ਲਿਖਦੀ ਵੀ ਹਾਂ ਲਿਖਣ ਦੀ ਮੇਰੀ ਰੂਟੀਨ ਰੋਜ਼ਾਨਾ ਦੀ ਰੂਟੀਨ ਹੈ ਕਿਉਂਕਿ ਜਦੋਂ ਮੈਂ ਬੱਚਿਆਂ ਨੂੰ ਲੈਕਚਰਜ਼ ਦੇਣਾ ਹੁੰਦਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਬੱਚਿਆਂ ਦਾ ਲੈਕਚਰ ਪ੍ਰਿਪੇਅਰ ਕਰਦੀ ਹਾਂ ਸੋ ਉਸ ਲੈਕਚਰ ਪ੍ਰੈਪਰੇਸ਼ਨ ਕਰਨ ਤੋਂ ਬਾਅਦ ਮੈਂ ਉਹਨੂੰ ਲਿਖਦੀ ਹਾਂ ਉਹਨਾਂ ਦੇ ਨੋਟਸ ਜੋ ਮੈਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਣੇ ਹੁੰਦੇ ਹਨ ਤੋ ਇਹ ਮੇਰੀ ਸ਼ੌਂਕ ਦੇ ਨਾਲ ਨਾਲ ਆਦਤ ਦੇ ਨਾਲ ਨਾਲ ਮੇਰੇ ਪ੍ਰੋਫੈਸ਼ਨ ਦੇ ਵਿੱਚ ਵੀ ਲਿਖਣਾ ਲਿਖਿਆ ਹੋਇਆ ਹੈ ਸੋ ਇਹ ਮੇਰੀ ਡੇਲੀ ਦੀ ਆਦਤ ਹੈ ਮੈਂ ਜਦੋਂ ਵੀ ਕੁਛ ਕਰਨਾ ਹੁੰਦਾ ਹੈ ਕੁਛ ਆਪਣਾ ਰੂਟੀਨ ਸਟਾਰਟ ਕਰਨਾ ਹੁੰਦਾ ਅਗਲੇ ਦਿਨ ਦਾ ਤਾਂ ਵੀ ਉਹ ਰੂਟੀਨ ਮੈਂ ਇੱਕ ਦਿਨ ਪਹਿਲਾਂ ਆਪਣੇ ਪੇਜ ਦੇ ਉੱਪਰ ਲਿਖਦੀ ਹਾਂ ਆਪਣਾ ਡੇ ਪਲੈਨ ਜਦੋਂ ਮੈਂ ਕਰਨਾ ਹੁੰਦਾ ਹੈ ਉਹਨੂੰ ਵੀ ਮੈਂ ਇੱਕ ਡਾਇਰੀ ਸਪੈਸ਼ਲ ਲਗਾਈ ਹੋਈ ਹੈ ਜਿਹਦੇ ਵਿੱਚ ਮੈਂ ਆਪਣਾ ਲਿਖਦੀ ਹਾਂ ਕਿ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਕੀ ਕਰਨਾ ਹੈ ਅਤੇ ਜਦੋਂ ਮੈਂ ਕਾਲਜ ਜਾਂਦੀ ਹਾਂ ਬਤੌਰ ਏ ਪ੍ਰੋਫੈਸ਼ਨਲ ਪ੍ਰੋਫੈਸਰ ਇੱਥੇ ਆਣ ਕੇ ਵੀ ਮੈਂ ਆਪਣਾ ਜੋ ਵੀ ਕਾ ਟਾਸਕ ਕਰਨਾ ਹੁੰਦਾ ਹੈ ਜੋ ਲੈਕਚਰ ਦੇਣਾ ਹੁੰਦਾ ਹੈ ਜਾਂ ਮੇਰਾ ਮੇਰੇ ਹੈਡ ਆਫ ਡਿਪਾਰਟਮੈਂਟ ਵੱਲੋਂ ਜੋ ਵੀ ਕੰਮ ਮੈਨੂੰ ਸੌਂਪਿਆ ਜਾਂਦਾ ਹੈ ਉਹਨੂੰ ਮੈਂ ਆਪਣੇ ਡਾਇਰੀ ਦੇ ਉੱਤੇ ਇੰਪੋਰਟੈਂਟ ਪੁਆਇੰਟਸ ਦੇ ਨਾਲ ਲਿਖ ਲੈਂਦੀ ਹਾਂ ਤਾਂ ਕਿ ਮੈਂ ਉਹਨੂੰ ਸਮੇਂ ਸਿਰ ਕੰਪਲੀਟ ਕਰ ਸਕਾਂ ਲਿਖਣਾ ਇੱਕ ਬਹੁਤ ਹੀ ਚੰਗੀ ਆਦਤ ਹੈ ਇਹ ਸਾਨੂੰ ਹਰ ਵੇਲੇ ਮਦਦ ਕਰਨ ਸਹਾਇਤਾ ਦਿੰਦੀ ਹੈ ਇਹ ਸਾਨੂੰ ਨਾ ਕਿ ਸਾਡੀ ਲਿਖਣ ਦੇ ਤਰੀਕੇ 'ਚ ਅੱਛਾ ਬਣਾਉਂਦੀ ਹੈ ਇਹਦੇ ਨਾਲ ਨਾਲ ਅਸੀਂ ਕੁਛ ਕੁ ਜ਼ਰੂਰੀ ਕੰਮ ਜੋ ਕਿ ਰੋਜ਼ ਮਰਹਾ ਦੀ ਜ਼ਿੰਦਗੀ ਚੋਂ ਭੁੱਲ ਜਾਂਦੇ ਹਾਂ ਉਹ ਇਹਨੂੰ ਕਰਕੇ ਅਸੀਂ ਲਿਖ ਸਕਦੇ ਹਾਂ ਔਰ ਬਣਾ ਸਕਦੇ ਹਾਂ ਸੋ ਇਹ ਮੇਰੀ ਆਦਤ ਮੈਨੂੰ ਖੁਦ ਵੀ ਬਹੁਤ ਪਸੰਦ ਹੈ ਅਤੇ ਮੈਂ ਉਮਰ ਭਰ ਹੀ ਇਸ ਤਰ੍ਹਾਂ ਆਪਣਾ ਲਿਖਣ ਵਾਲੇ ਆਦਤ ਜਾਂ ਰੂਟੀਨ ਨੂੰ ਕਦੇ ਵੀ ਨਹੀਂ ਤੋੜਨਾ ਚਾਹਵਾਂਗੀ ਮੇਰੀ ਸਭ ਤੋਂ ਪਸੰਦੀਦਾ ਅਤੇ ਸਭ ਤੋਂ ਚੰਗੀ ਆਦਤ ਹੈ ਲਿਖਣਾ ਸੋ ਮੈਨੂੰ ਇਹ ਬਹੁਤ ਜ਼ਿਆਦਾ ਪਸੰਦ ਹੈ ਇਸ ਲਈ ਮੈਂ ਸਾਰਿਆਂ ਨੂੰ ਪ੍ਰੇਰਿਤ ਵੀ ਕਰਦੀ ਹਾਂ ਸਾਨੂੰ ਲਿਖਣਾ ਜ਼ਰੂਰ ਚਾਹੀਦਾ ਹੈ ਲਿਖਣ ਨਾਲ ਸਾਡੀਆਂ ਬਹੁਤ ਸਾਰੀਆਂ ਆਦਤਾਂ ਜੋ ਹਨ ਚੰਗੀਆਂ ਹੋ ਜਾਂਦੀਆਂ ਹਨ